ਮੇਰੀ ਅੱਜ ਤੱਕ ਦੀ ਮਨ ਪਸੰਦੀਦਾ ਫਿਲਮ ਜੋ ਕਿ ਸਿੱਖ ਹਿਸਟਰੀ ਨਾਲ ਰਿਲੇਟਡ ਹੈ ਚਾਰ ਸਾਹਿਬਜ਼ਾਦੇ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਹੀ ਹੋਵੇਗਾ ਕਿ ਆਪਣੇ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ 'ਤੇ ਇੱਕ ਫਿਲਮ ਬਣੀ ਹੈ ਜੋ ਕਿ ਉਹਨਾਂ ਦੇ ਜੀਵਨ ਨੂੰ ਉਸ ਵਿੱਚ ਦਰਸਾਇਆ ਗਿਆ ਹੈ ਆਪਣੇ ਇਸ ਫਿਲਮ ਵਿੱਚ ਮੈਨੂੰ ਸਭ ਤੋਂ ਪਸੰਦ ਇਹੀ ਲੱਗਿਆ ਕਿ ਅੱਜ ਕੱਲ੍ਹ ਕੋਈ ਵੀ ਫਿਲਮਾਂ ਬਹੁਤ ਬਣਦੀਆਂ ਨੇ ਪਰ ਮਨੋਰੰਜਨ ਲਈ ਬਣਦੀਆਂ ਨੇ ਪਰ ਇਹ ਫਿਲਮ ਇੱਕ ਵੱਖਰਾ ਹਟ ਕੇ ਬਣੀ ਹੈ ਜੋ ਕਿ ਆਪਣੀ ਹਿਸਟਰੀ ਨੂੰ ਵਰਲਡਵਾਈਡ ਚੱਲੀ ਸੀ ਇਹ ਫਿਲਮ ਦਰਸਾਉਂਦੀ ਹੈ ਆਪਣੀ ਹਿਸਟਰੀ ਨੂੰ ਦਰਸਾਉਂਦੀ ਹੈ ਅਤੇ ਅੱਜ ਕੱਲ੍ਹ ਦੇ ਬੱਚੇ ਇਹ ਫਿਲਮਾਂ ਨਾ ਦੇਖਦੇ ਹੋਏ ਜ਼ਿਆਦਾ ਹੋਲੀਵੁੱਡ ਬੋਲੀਵੁੱਡ ਇਹ ਫਿਲਮਾਂ ਵੱਲ ਰੁਝਾਨ ਦਿੰਦੇ ਨੇ ਜਿਸ ਕਰਕੇ ਆਪਣਾ ਕਲਚਰ ਵੀ ਬਸ ਥੋੜ੍ਹਾ ਬਹੁਤਾ ਅਲੋਪ ਹੁੰਦਾ ਜਾ ਰਿਹਾ ਏ